ਮੈਂ ਇੱਕ ਰਜਾਈ ਮੰਗਵਾਈ ਸੀ ਅਤੇ ਇਹ ਰਜਾਈ ਜਿਹੜੀ ਬਹੁਤ ਹਲਕੀ ਨਿਕਲੀ ਟੀ ਵੀ 'ਚ ਦਿਖਾਇਆ ਕੁਛ ਹੋਰ ਸੀ ਅਤੇ ਉਹ ਜਦੋਂ ਮੰਗਵਾਈ ਤਾਂ ਬਹੁਤ ਹੀ ਹਲਕੀ ਕੁਆਲਟੀ ਦੀ ਨਿਕਲੀ ਅਤੇ ਉਹਦੇ 'ਚ ਠੰਡ ਵੀ ਬਿਲਕੁਲ ਨਹੀਂ ਰੁਕਦੀ ਅਤੇ ਉਹਦਾ ਕਲਰ ਵੀ ਧੁੱਪੇ ਪਾਉਣ 'ਤੇ ਬਿਲਕੁਲ ਉੱਡ ਗਿਆ ਅਤੇ ਬਿਲਕੁਲ ਚੰਗੀ ਨਹੀਂ ਆ ਮੈਨੂੰ ਇਹ ਪ੍ਰੋਡਕਟ ਵਧੀਆ ਨਹੀਂ ਲੱਗਿਆ